ਗੁਰਦਾਸਪੁਰ ਜਿਲ੍ਹੇ ਵਿੱਚ ਮੁੱਖ ਸਿਹਤ ਸੰਭਾਲ ਸਹੂਲਤਾਂ ਅਤੇ ਸੇਵਾਵਾਂ ਕਈ ਸਾਰੀਆਂ ਉਪਲੱਬਧ ਹਨ ਜਿਹਨਾਂ ਵਿੱਚੋਂ ਸਭ ਤੋਂ ਵੱਡਾ ਹੋਸਪੀਟਲ ਮਹਾਜਨ ਹੋਸਪੀਟਲ ਹੈ ਜਿੱਥੇ ਕਿ ਆਈ ਆਈ ਕੇਅਰਸ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿੱਦਾਂ ਕਿ ਦਿਓਲ ਮਲਟੀ ਮਲਟੀ ਸਪੈਸਲਿਸਟ ਹੋਸਪੀਟਲ ਹੈ ਪੰਜਾਬ ਮੈਡੀਕਲ ਸਟੋਰ ਵੀ ਹੈ ਸਿਟੀ ਹੋਸਪੀਟਲਸ ਵੀ ਹੈ ਔਰ ਵੀ ਕਈ ਸਾਰੇ ਹੋਸਪੀਟਲ ਹੈ ਜੇ ਆਪਾਂ ਗੱਲ ਕਰੀਏ ਫਾਰਮੇਸੀਆਂ ਉਹ ਉਹ ਤਾਂ ਸਭ ਤੋਂ ਵਧੀਆ ਪੰਜਾਬ ਫਾਰਮੇਸੀ ਹੈ ਕਮਿਊਨਟੀ ਹੈਲਥ ਸੈਂਟਰ ਵੀ ਕਈ ਸਾਰੇ ਹੈ ਪੰਜਾਬ ਵਿੱਚ ਜਿਹਨਾਂ ਵਿੱਚ ਕਿ ਲੋਕਾਂ ਨੂੰ ਮਤਲਬ ਬਹੁਤ ਹੀ ਘੱਟ ਰੇਟ 'ਤੇ ਜਿਹੜੀਆਂ ਉਹ ਦਵਾਈਆਂ ਉਪਲੱਬਧ ਕਰਵਾਈਆਂ ਜਾਂਦੀਆਂ ਕਈ ਸਾਰੇ ਪਿੰਡਾਂ ਵਿੱਚ ਕਮਿਊਨਟੀ ਹੈਲਥ ਸੈਂਟਰ ਬਹੁਤ ਵਧੀਆ ਕੰਮ ਕਰ ਰਿਹਾ ਪਰ ਕਈ ਕਈ ਸਾਰੀਆਂ ਇੱਦਾਂ ਦੀਆਂ ਥਾਵਾਂ ਕੀ ਜਿੱਥੇ ਕਮਿਊਨਟੀ ਹੈਲਥ ਸੈਂਟਰ ਜਿਹੜੇ ਆ ਵੋ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹੁਣ ਆਪਾਂ ਗੱਲ ਕਰੀਏ ਕੋਵਿਡ ਮਹਾਂਮਾਰੀ ਦੌਰਾਨ ਹੋਸਪੀਟਲਾਂ ਵਾਲਿਆਂ ਨੇ ਕਿਮਾ ਕਿਵੇਂ ਕੰਮ ਕੀਤਾ ਜਦੋਂ ਕਿ ਕੋਵਿਡ ਮਹਾਂਮਾਰੀ ਆਈ ਸੀ ਤਾਂ ਪਹਿਲਾਂ ਤਾਂ ਮਤਲਬ ਸਾਡੇ ਗੁਰਦਾਸਪੁਰ ਜਿਲ੍ਹੇ ਵਿੱਚ ਉਹਦਾ ਪ੍ਰਭਾਵ ਬਹੁਤ ਹੀ ਘੱਟ ਸੀ ਮਤਲਬ ਕਿ ਲੋਕਾਂ ਪਰ ਫਿਰ ਵੀ ਹੋਸਪੀਟਲਸ ਵਾਲਿਆਂ ਨੇ ਕਾਫ਼ੀ ਸਾਰਿਆਂ ਲੋਕਾਂ ਨੂੰ ਪ੍ਰੋਟੈਕਸ਼ਨ ਦੱਸੀਆਂ ਕਿ ਘਰੋਂ ਜ਼ਿਆਦਾ ਬਾਹਰ ਨਹੀਂ ਨਿਕਲਣਾ ਕਿਸੀ ਨੂੰ ਜ਼ਿਆਦਾ ਨਹੀਂ ਬੁਲਾਉਣਾ ਕਿਸੀ ਨਾਲ ਜ਼ਿਆਦਾ ਗੱਲ ਨਹੀਂ ਕਰਨੀ ਐਕਸੈਕਟਰਾ ਐਕਸੈਕਟਰਾ